ਸਾਡੇ ਪਿੰਡ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਕੰਮ ਕੀਤਾ ਹੈ ਉਹਨਾਂ ਨੇ ਯੋਗਸ਼ਾਲਾ ਅਤੇ ਆਮ ਆਦਮੀ ਪਾਰਟੀ ਕਲੀਨਿਕ ਖੋਲ੍ਹੇ ਹਨ ਯੋਗਸ਼ਾਲਾ ਵਿੱਚ ਬਹੁਤ ਸਾਰੇ ਲੋਕ ਯੋਗਾ ਆਉਂਦੇ ਹਨ ਅਤੇ ਯੋਗਾ ਸਿੱਖਦੇ ਹਨ ਅਤੇ ਮੁਫਤ ਵਿੱਚ ਆਪਣਾ ਯੋਗਾ ਸਿੱਖ ਕੇ ਆਪਣੇ ਮਾਨਸਿਕ ਅਤੇ ਸਰੀਰਕ ਸੰਤੁਲਨ ਨੂੰ ਸੰਭਾਲਦੇ ਹਨ ਉੱਥੇ ਬੱਚੇ ਬੁੱਢੇ ਜਨਾਨੀ ਮਰਦ ਸਾਰੇ ਜਾਂਦੇ ਹਨ ਅਤੇ ਯੋਗਾ ਸਿੱਖਦੇ ਹਨ ਨਾਲ ਆਮ ਆਦਮੀ ਕਲੀਨਿਕ ਵਿੱਚ ਲੋਕ ਜਾਂਦੇ ਹਨ ਅਤੇ ਆਪਣੀ ਬਿਮਾਰੀਆਂ ਲਈ ਵੱਖ ਵੱਖ ਦਵਾਈਆਂ ਲੈਂਦੇ ਹਨ ਉਹ ਵੀ ਅਫ ਮੁਫਤ ਵਿੱਚ ਅਤੇ ਅਤੇ ਘੱਟ ਰੇਟ ਵਿੱਚ ਦਵਾਈਆਂ ਲੈਂਦੇ ਹਨ ਧੰਨਵਾਦ